ਇੱਕ ਵਾਰ ਮੇਰੇ ਕੋਲੇਜ ਵਿੱਚ ਫੰਕਸ਼ਨ ਹੋਇਆ ਸੀਗਾ ਕੰਪਟੀਸ਼ਨ ਹੋਇਆ ਸੀ ਮਦਰਸ ਡੇਅ 'ਤੇ ਅਤੇ ਮੈਂ ਆਪਣੀ ਮਾਤਾ ਦੀ ਫੋਟੋ ਆਪਣੀ ਚਿੱਤਰ ਨੂੰ ਦਰਸਾਉਂਦੇ ਹੋਏ ਇੱਕ ਮਦਰ ਦਾ ਸਕੈਚ ਬਣਾਇਆ ਸੀਗਾ ਜਿਸ ਵਿੱਚ ਉਸ ਮਾਂ ਨੇ ਇੱਕ ਉਸਦੇ ਕਈ ਹੱਥ ਬਣਾਏ ਸਨ ਜਿਸ ਵਿੱਚ ਇੱਕ ਹੱਥ ਵਿੱਚ ਉਸਨੇ ਰਸੋਈ ਦਾ ਇੱਕ ਚਮਚ ਫੜਿਆ ਹੋਇਆ ਸੀਗਾ ਵੇਲਣ ਫੜਿਆ ਹੋਇਆ ਸੀਗਾ ਦੂਸਰੇ ਹੱਥ ਵਿੱਚ ਉਸਨੇ ਕਿਤਾਬ ਫੜੀ ਹੋਈ ਸੀ ਤੀਸਰੇ ਵਿੱਚ ਉਸਨੇ ਆਪਣਾ ਬੱਚਾ ਚੱਕਿਆ ਹੋਇਆ ਸੀਗਾ ਚੌਥੇ ਵਿੱਚ ਉਸਨੇ ਪਰਸ ਚੱਕਿਆ ਹੋਇਆ ਸੀ ਘਰ ਦੀ ਸਾਰੀ ਜਿੰਮੇਵਾਰੀ ਚੱਕੀ ਹੋਈ ਸੀ ਉਹ ਫੋਟੋ ਇਹ ਦਰਸਾਉਂਦੀ ਸੀਗੀ ਉਹ ਮੈਂ ਉਹ ਫੋਟੋ ਮੈਂ ਇਹ ਸੋਚ ਕੇ ਬਣਾਈ ਸੀ ਜੋ ਕਿ ਮੇਰੇ ਮਾਤਾ ਦੇ ਚਿੱਤਰ ਨੂੰ ਦਰਸਾਉਂਦੀ ਹੈ ਕਿ ਇਵੇਂ ਹੀ ਮੇਰੇ ਮਾਂ ਮੇਰੇ ਮਾਤਾ ਸ਼੍ਰੀ ਜੋ ਕਿ ਸਾਨੂੰ ਵੀ ਪਾਲਦੇ ਹਨ ਸਾਨੂੰ ਪੜ੍ਹਾਉਂਦੇ ਹਨ ਖੁਦ ਵੀ ਜੋਬ ਕਰਦੇ ਹਨ ਘਰ ਦਾ ਵੀ ਸਾਰਾ ਦੇਖਦੇ ਸਨ ਦੇਖਦੇ ਹਨ ਸਾਰੀ ਜਿੰਮੇਵਾਰੀਆਂ ਹਰ ਇੱਕ ਕੰਮ ਬਹੁਤ ਅੱਛੇ ਤਰੀਕੇ ਨਾਲ ਕਰਦੇ ਹਨ ਕਿ ਇੰਸ ਕਿ ਔਰਤ ਦੇ ਬਹੁਤ ਸਾਰੇ ਹੱਥ ਹੁੰਦੇ ਹਨ ਕਿ ਉਹ ਬਹੁਤ ਹੀ ਜ਼ਿਆਦਾ ਮਿਹਨਤ ਕਰਦੀ ਹੈ ਸਾਰਾ ਦਿਨ ਮੈਂ ਉਹ ਚੀਜ਼ ਆਪ ਉਹ ਤਸਵੀਰ ਆਪਣੀ ਮਾਤਾ ਦੇ ਚਿੱਤਰ ਨੂੰ ਦਰਸਾਉਂਦੇ ਹੋਏ ਬਣਾਈ ਸੀ ਕਿ ਮੇਰੀ ਮਾਂ ਬਹੁਤ ਹੀ ਬੋਲਡ ਲੇਡੀ ਨੇ ਜੋ ਕਿ ਹਰ ਇੱਕ ਚੀਜ਼ ਬਹੁਤ ਹੀ ਪ੍ਰਫੈਕਸ਼ਨ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਸ਼ਿੱਦਤ ਨਾਲ ਕਰਦੇ ਹਨ ਸਾਰਾ ਦਿਨ ਸਾਡੀ ਵੀ ਦੇਖਭਾਲ ਕਰਦੇ ਹਨ ਅਤੇ ਬਾਹਰ ਕੰਮ ਜੋਬ ਵੀ ਕਰਦੇ ਹਨ ਸਾਨੂੰ ਵੀ ਪੜ੍ਹਾਉਂਦੇ ਹਨ ਅਤੇ ਘਰ ਦਾ ਵੀ ਸਾਰਾ ਕੁਛ ਦੇਖਦੇ ਹਨ ਇਹ ਤਸਵੀਰ ਜਦੋਂ ਮੈਂ ਬਣਾਈ ਤੇ ਮੇਰੇ ਮਾਪੇ ਮੇਰੇ ਦੋਸਤਾਂ ਨੂੰ ਮੇਰੇ ਉੱਤੇ ਬਹੁਤ ਮਾਣ ਹੋਇਆ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਬਹੁਤ ਹੀ ਅੱ ਕਿ ਮੇਰਾ ਹੱਥ ਬਹੁਤ ਹੀ ਸਾਫ਼ ਸੀ ਮੈਂ ਬਹੁਤ ਹੀ ਅੱਛੀ ਚਿੱਤਰ ਬਣਾਇਆ ਸੀ ਅਤੇ ਮੈਂ ਉਸ ਕੰਪੀਟੀਸ਼ਨ ਵਿੱਚ ਫਸਟ ਵੀ ਆਈ ਸੀ ਮੇਰੇ ਘਰਦਿਆਂ ਨੇ ਮੈਨੂੰ ਇਹ ਕਿਹਾ ਮੇਰੇ ਦੋਸਤਾਂ ਨੇ ਵੀ ਮੈਨੂੰ ਇਹ ਫੀਡਬੈਕ ਦਿੱਤੀ ਕਿ ਤੂੰ ਇਸ ਵਿੱਚ ਹੋਰ ਅੱਗੇ ਵੱਧ ਸਕਦੀ ਹੈ ਕਿਉਂਕਿ ਮੈਨੇ ਮੈਂ ਕੋਵਿਡ ਵਿੱਚ ਇਸ ਚੀਜ਼ ਵਿੱਚ ਬਹੁਤ ਹੀ ਆਪਣਾ ਇੰਟਰਸਟ ਦਿਖਾ ਕੇ ਆਪਣੀ ਬਹੁਤ ਹੀ ਇਸ ਇਸ ਸਕਿੱਲ ਨੂੰ ਸਟਰੋਂਗ ਕੀਤਾ ਮੈਂ ਬਹੁਤ ਹੀ ਔਨਲਾਈਨ ਕੋਰਸ ਵੀ ਜੁਆਇਨ ਕੀਤੇ ਅਪ ਔਨਲਾਈਨ ਸਕੈਚਿੰਗ ਸਿੱਖੀ ਓਇਲ ਪੇਂਟਿੰਗ ਸਿੱਖੀ ਕਰਾਫਟ ਸਿੱਖਿਆ ਬਹੁਤ ਕੁਛ ਸਿੱਖਿਆ ਮੇਰੇ ਘਰਦਿਆਂ ਨੇ ਮੈਨੂੰ ਸੁਜੈਸਟ ਕੀਤਾ ਕਿ ਤੂੰ ਆਪਣੀ ਡਿਗਰੀ ਤੋਂ ਬਾਅਦ ਤੂੰ ਖੁਦ ਦੀ ਇੱਕ ਅਕੈਡਮੀ ਵੀ ਖੋਲ੍ਹ ਸਕਦੀ ਹੈ ਜਾਂ ਕੋਈ ਟੀਚਰ ਦੀ ਜੋਬ ਕਰ ਸਕਦੀ ਹੈ ਐਜ਼ ਆ ਡਰੋਇੰਗ ਟੀਚਰ ਤੂੰ ਆਪਣਾ ਕ ਆਪਣਾ ਫਿਊਚਰ ਇਹਦੇ ਵਿੱਚ ਹੋਰ ਸਿਕਿਓਰ ਕਰ ਸਕਦੀ ਹਾਂ ਤੂੰ ਹੋਰ ਅੱਗੇ ਵੱਧ ਸਕਦੀ ਹੈ ਇਸ ਚੀਜ਼ ਨੂੰ ਲੈ ਕੇ ਮੈਨੂੰ ਬਹੁਤ ਹੀ ਅੱਛੇ ਫੀਡਬੈਕ ਦਿੱਤੇ ਅਤੇ ਮੈਨੂੰ ਹੋਰ ਉਮੀਦ ਦਿੱਤੀ ਅੱਗੇ ਵਧਣ ਦੀ ਮੇਰਾ ਇਹ ਹੁਨਰ ਮੈਨੂੰ ਬਹੁਤ ਮਾਣ ਹੈ ਕਿ ਮੇਰੇ ਘਰਦਿਆਂ ਨੂੰ ਮੇਰੇ ਦੋਸਤਾਂ ਨੂੰ ਮੇਰੇ ਮਾਂ ਪਿਓ ਨੂੰ ਮੈਨੂੰ ਵੀ ਬਹੁਤ ਮਾਣ ਹੈ ਕਿ ਮੈਂ ਇੰਨੀ ਚੀ ਇੰਨੀ ਵਧੀਆ ਚੀਜ਼ ਬਣਾਈ ਅਤੇ ਮੈਂ ਬਹੁਤ ਵਧੀਆ ਹੀ ਡਰੋਇੰਗ ਕਰ ਲੈਂਦੀ ਹਾਂ